ਸਤਿ ਸ਼੍ਰੀ ਅਕਾਲ ਜੀ ਆਪਣੇ ਆਪ ਨੂੰ ਫਿੱਟ ਰੱਖਣ ਦੇ ਲਈ ਅਤੇ ਘੱਟ ਪੈਟਰੋਲ ਯੂਜ ਕਰਨ ਦੇ ਲਈ ਮੈਂ ਵੀ ਸਾਈਕਲਿੰਗ ਕਾਫੀ ਕੀਤੀ ਹੋਈ ਹੈ ਜੀ ਅਤੇ ਇਹਦੇ ਵਿੱਚ ਸਭ ਤੋਂ ਜ਼ਿਆਦਾ ਚੁਣੌਤੀਪੂਰਨ ਜਿਹੜਾ ਸਾਈਕਲਿੰਗ ਮੇਰੀ ਰਹੀ ਜਿੱਥੇ ਮੈਂ ਗਿਆ ਉਹ ਤਾਂ ਜੀ ਕੋਈ ਇੰਨੀ ਜ਼ਿਆਦਾ ਚੁਣੌਤੀਪੂਰਨ ਤਾਂ ਕੋਈ ਜ਼ਿਆਦਾ ਕੋਈ ਐਕਸਪੀਰੀਅੰਸ ਮੈਨੂੰ ਯਾਦ ਨਹੀਂ ਆ ਰਿਹਾ ਇੱਕ ਵਾਰੀ ਬਸ ਬਠਿੰਡੇ ਹੀ ਮੈਂ ਕਿਲ੍ਹਾ ਮੁਬਾਰਕ ਦੀ ਸਾਈਡ ਇੱਕ ਵਾਰੀ ਸਾਈਕਲ 'ਤੇ ਜਾ ਰਿਹਾ ਸੀ ਅਤੇ ਉਹ ਜਿਹੜਾ ਰਸਤਾ ਉਹ ਚੜ੍ਹਾਈ ਵਾਲਾ ਰਸਤਾ ਥੋੜ੍ਹਾ ਅਤੇ ਉੱਤੇ ਚੜ੍ਹਾਉਣੀ ਸਾਈਕਲ ਕਾਫੀ ਜ਼ੋਰ ਜਿਹਾ ਲੱਗਿਆ ਅਤੇ ਕਾਫੀ ਗਰਮੀਆਂ ਦੇ ਦਿਨ ਸੀਗੇ ਜੀ ਮਈ ਜੂਨ ਦੇ ਇਹੀ ਅਤੇ ਪਿਛਲੇ ਸਾਲ ਦੀ ਗੱਲ ਹੈ ਤਾਂ ਬਾਹਲਾ ਮਤਲਬ ਬੁਰਾ ਹਾਲ ਹੋ ਗਿਆ ਸੀ ਉੱਥੇ ਅਤੇ ਨਾਲੇ ਦੂਜੀ ਗੱਲ ਉੱਥੇ ਟਰੈਫਿਕ ਵੀ ਬਾਹਲਾ ਰਹਿੰਦਾ ਕਿਲ੍ਹਾ ਮੁਬਾਰਕ ਦੀ ਸਾਈਡ 'ਤੇ ਅੱਗਿਓਂ ਉਹ ਗਲੀ ਵੀ ਜਿਹੜੀ ਗਲੀ ਆ ਉਹ ਵੀ ਕਾਫੀ ਬਾਹਲੀ ਐਂਹ ਪਤਲੀ ਜਿਹੀ ਹੈਗੀ ਅਤੇ ਜਿਵੇਂ ਇੱਕ ਗੱਡੀ ਆ ਗਈ ਤਾਂ ਫਿਰ ਸਾਈਡਾਂ 'ਚ ਥਾਂ ਹੀ ਨਹੀਂ ਹੁੰਦੀ ਸਾਈਕਲ ਲੰਘਾਉਣ ਦੀ ਵੀ ਅਤੇ ਤਾਂ ਕਰਕੇ ਫਿਰ ਉੱਥੇ ਜਾਣਾ ਕਾਫੀ ਟਰੈਫਿਕ ਨੇ ਵੀ ਕਾਫੀ ਪਰੇਸ਼ਾਨ ਕੀਤਾ ਅਤੇ ਗਰਮੀ ਨੇ ਵੀ ਕੀਤਾ ਅਤੇ ਉੱਤੋਂ ਦੀ ਉਹ ਚੜ੍ਹਾਈ ਜਿਹੀ ਆ ਗਈ ਸੀ ਉਹ ਐਕਸਪੀਰੀਅੰਸ ਮੇਰਾ ਥੋੜ੍ਹਾ ਸਾਇਕਲ ਵਾਲਾ ਚੁਣੌਤੀਪੂਰਨ ਰਿਹਾ ਸੀ ਬਾਕੀ ਤਾਂ ਜੀ ਸਾਈਕਲਿੰਗ ਵਧੀਆ ਹੀ ਰਹੀ ਹੈ